ਬਿਜਲੀ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਸਾਨੂੰ ਬਿਜਲੀ ਦੇ ਅਸੀਂ ਲਗਭਗ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਬਿਜਲੀ ਦੀ ਮਹੱਤਤਾ ਬਾਰੇ ਬਹੁਤ ਹੀ ਚੰਗੀ ਤਰ੍ਹਾਂ ਅਸੀਂ ਇਸ ਬਾਰੇ ਗੱਲ ਕਰ ਸਕਦੇ ਹਾਂ ਕਿ ਰੋਜ਼ਾਨਾ ਜੀਵਨ ਵਿੱਚ ਅਸੀਂ ਵੱਖ ਵੱਖ ਤਰ੍ਹਾਂ ਦੇ ਜੋ ਘਰੇਲੂ ਉਪਕਰਨ ਹਨ ਉਹ ਉਹ ਬਿਜਲੀ 'ਤੇ ਹੀ ਚੱਲਦੇ ਹਨ ਅਤੇ ਜੇਕਰ ਸਾਨੂੰ ਇੱਕ ਦਿਨ ਦੇ ਵਿੱਚ ਬ ਬਿਜਲੀ ਬੋਰਡ ਵੱਲੋਂ ਦੋ ਘੰਟੇ ਵੀ ਕੱਟ ਲੱਗ ਜਾਵੇ ਤਾਂ ਸਾਡੀ ਜ਼ਿੰਦਗੀ 'ਤੇ ਇਸਦਾ ਰੋਜ਼ਾਨਾ ਰੂਟੀਨ ਦੇ ਉੱਪਰ ਜੋ ਡੇਲੀ ਸਾਡੀ ਰੂਟੀਨ ਹੈ ਉਸ 'ਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪੈਂਦਾ ਹੈ ਪਰੰਤੂ ਬਿਜਲੀ ਦੇ ਵੱਖ ਵੱਖ ਤਰ੍ਹਾਂ ਦੇ ਖਤਰੇ ਵੀ ਹੋ ਸਕਦੇ ਹਨ ਜੇਕਰ ਅਸੀਂ ਨੰਗੇ ਪੈਰੀ ਜਾਂ ਗਿੱਲੇ ਪੈਰੀ ਕਿਸੇ ਬਿਜਲੀ ਵਾਲੇ ਸਵਿੱਚ ਨੂੰ ਹੱਥ ਲਾਈਏ ਤਾਂ ਉਸ 'ਤੇ ਇੱਕ ਸਾਨੂੰ ਝਟਕਾ ਬਹੁਤ ਹੀ ਝਟਕਾ ਵੱਜਦਾ ਹੈ ਅਤੇ ਇਸ ਤੋਂ ਇਲਾਵਾ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਜੋ ਬਿਜਲੀ ਨਾਲ ਸੰਬੰਧਿਤ ਜੋ ਉਪਕਰਨ ਹਨ ਜੇਕਰ ਉਹ ਕੁਝ ਟਾਈਮ ਬਾਅਦ ਖਰਾਬ ਹੋ ਜਾਣ ਜਾਂ ਉਹਨਾਂ ਦੀ ਕੋਈ ਵੀ ਤਾਰ ਹੈ ਉਹ ਉਸ ਉਪਕਰਨ ਦੀ ਲੋਹੇ ਦੀ ਬਾਡੀ ਦੇ ਨਾਲ ਲੋਹੇ ਦੀ ਜਿਹੜੀ ਉਹਦੀ ਬਣਤਰ ਹੈ ਉਹਦੇ ਨਾਲ ਨਾਲ ਛੂਹ ਜਾਵੇ ਤਾਂ ਉਸ ਤਰ੍ਹਾਂ ਅਗਰ ਤੁਸੀਂ ਮੰਨ ਲਉ ਕੂਲਰ ਹੈ ਕੂਲਰ ਨੂੰ ਦੀ ਬਾਡੀ ਦੇ ਨਾਲ ਛੂਹ ਜਾਵੇ ਅਤੇ ਜੇਕਰ ਤੁਸੀਂ ਕੂਲਰ ਨੂੰ ਹੱਥ ਲਾਉਨੇ ਹਾਂ ਤਾਂ ਉਸ ਸੰਬੰਧੀ ਤੁਹਾਨੂੰ ਝਕਟਾ ਵੀ ਵੱਜ ਸਕਦਾ ਹੈ ਤਾਂ ਇਸ ਸੰਬੰਧੀ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਚੰਗੀ ਜੋ ਗੁਣਵਕਤਾ ਵਾਲੇ ਹਨ ਜਾਂ ਉਸ ਤਰ੍ਹਾਂ ਦੇ ਇਕੁਮੈਂਟ ਹੀ ਸਾਨੂੰ ਉਸ ਤਰ੍ਹਾਂ ਦੇ ਉਪਕਰਨ ਹੀ ਸਾਨੂੰ ਵਰਤਣੇ ਚਾਹੀਦੇ ਹਨ